ਸਤਿ ਸ਼੍ਰੀ ਅਕਾਲ ਕਿਵੇਂ ਹੋ ਬਸ ਵਧੀਆ ਕੁਛ ਨਹੀਂ ਘਰਦਾ ਕੰਮ ਕਰਕੇ ਹਟੇ ਸੀ

ਹਾਂਜੀ ਛੇਤੀ ਕਰ ਲੈਂਦੇ ਹੁਣ ਨਾ ਹਨੇਰਾ ਛੇਤੀ ਹੋਣ ਲੱਗ ਗਿਆ ਸਰਦੀਆਂ ਦਾ ਮੌਸਮ ਹੈ ਹਾਂਜੀ ਮੈਮ ਹੋਰ ਦੱਸੋ ਮੈਮ ਕਿਵੇਂ ਅੱਛਾ ਹੋਰ ਦੱਸੋ

ਅੱਛਾ ਹਾਂ ਚਲੋ ਵਧਾਈਆਂ ਹੋਣ ਅੱਛਾ ਮੈਮ ਚਲੋ ਵਧਾਈਆਂ ਹੋਣ ਤੁਹਾਨੂੰ ਕਿਹੜੀ ਗੱਡੀ ਲਿਤੀ ਅੱਛਾ ਮੈਮ ਚਲੋ ਬਹੁਤ ਬਹੁਤ ਵਧਾਈਆਂ ਜੀ ਹਾਂਜੀ ਹਾਂਜੀ ਮੈਮ ਹੋਣਾ ਹੀ ਚਾਹੀਦਾ ਕੋਈ ਦਿੱਕਤ ਨਾ ਹੋਵੇ ਅੱਛਾ ਮੈਮ ਅੱਛਾ ਹਾਂਜੀ ਹਾਂਜੀ ਬਿਲਕੁਲ ਮੈਮ ਸਵੇਰ ਦੇ ਟਾਈਮ ਅਤੇ ਛੁੱਟੀ ਦੇ ਟਾਈਮ 'ਤੇ ਬਹੁਤ ਰਸ਼ ਹੁੰਦਾ ਇਥੇ ਕਿਉਂਕਿ ਇੰਨਾਂ ਵੱਡਾ ਸ਼ਹਿਰ ਨਹੀਂ ਹੈਗਾ ਆਪਣਾ ਇਹ ਫਿਰ ਇੱਕੋ ਹੀ ਥਾਂ ਤੋਂ ਸਾਰੇ ਜਾਂਦੇ ਆ ਬਹੁਤ ਰਸ਼ ਹੋ ਜਾਂਦਾ ਹਾਂਜੀ ਹਾਂਜੀ ਮੈਮ ਹੋਰ ਮੈਮ ਹਾਂਜੀ ਮੈਮ ਤੁਸੀਂ ਕਿੱਧਰਲੀ ਸਾਈਡ ਤੋਂ ਆਉਂਦੇ ਹੋ ਕਿੱਧਰਲੀ ਸਾਈਡ ਤੋਂ ਆਉਂਦੇ ਹੋ ਤੁਸੀਂ ਅੱਛਾ ਮੈਮ ਉਧਰੋਂ ਮੈਮ ਹਾਂਜੀ ਮੈਮ ਉੱਧਰ ਦੋ ਰਾਹ ਹੁੰਦੇ ਹੋਣਗੇ ਤੁਸੀਂ ਇੱਕ ਜਿਹੜਾ ਜਿੱਥੋਂ ਸਾਰੇ ਜਾਂਦੇ ਹੁੰਦੇ ਆ ਸਕੂਲ ਵਗੈਰਾ ਛੱਡਣ ਵਾਸਤੇ ਉੱਧਰਲੇ ਰਾਹ ਤੋਂ ਨਾ ਜਾਇਆ ਕਰੋ ਇੱਕ ਸ਼ੋਰਟਕਟ ਹੈਗਾ ਉੱਥੋਂ ਹਾਂਜੀ ਉੱਦਾਂ ਇੱਕ ਗਲੀ ਆਉਂਦੀ ਹੈ ਉੱਧਰੋਂ ਤੁਸੀਂ ਆ ਸਕਦੇ ਹੋ ਸਿੱਧਾ ਸਿੱਧਾ ਹੀ ਰਾਹ ਹੈਗਾ ਹਾਂਜੀ ਮੈਮ

ਹਾਂਜੀ ਹਾਂਜੀ ਬਿਲਕੁਲ ਕਿਉਂਕਿ ਪਤਾ ਹੀ ਤੁਹਾਨੂੰ ਵੀ ਸਵੇਰ ਦਾ ਟਾਈਮ ਸਕੂਲ ਸਾਰਿਆਂ ਦਾ ਸਕੂਲ ਜਾਣ ਦਾ ਹੁੰਦਾ ਕੋਈ ਆਫਿਸ ਅਤੇ ਕੋਈ ਕਿੱਥੇ ਕੋਈ ਕਿੱਥੇ ਬਸ ਐਈਂ ਰੱਸ਼ ਹੋ ਜਾਂਦਾ ਇਕੱਠਾ ਗਲੀਆਂ ਇੱਥੇ ਭੀੜੀਆਂ ਭੀੜੀਆਂ ਹੈਗੀਆਂ ਹਾਂਜੀ ਹੋਰ ਹਾਂ ਬਿਲਕੁਲ ਚਲੋ ਤੁਸੀਂ ਸ਼ੁੱਭ ਸ਼ੁੱਭ ਬੋਲੋ ਤੁਸੀਂ ਕਾਹਤੋਂ ਮਾੜਾ ਸੋਚਣਾ ਹਾਂਜੀ ਬਿਲਕੁਲ ਸਹੀ ਗੱਲ ਹੈ ਮੈਮ ਹਾਂਜੀ ਹਾਂਜੀ ਕੋਈ ਨਾ ਮੈਮ ਓਕੇ ਬਾਏ